ਹੈਲੋ ਫਲਿਪਕਾਰ ਕਸਟਮਰ ਕੇਅਰ ਤੋਂ ਬੋਲ ਰਹੇ ਹੋ ਹਾਂਜੀ ਮੈਂ ਇੱਕ ਮਤਲਬ ਨਿਊ ਡ੍ਰੇਸ ਓਡਰ ਕੀਤੀ ਸੀਗੀ ਹਾਂਜੀ ਮੈਂ ਆਪਦੇ ਬਰਥਡੇ 'ਤੇ ਪਾਉਣੀ ਸੀ ਜੀ ਉਹ ਡ੍ਰੇਸ ਹਾਂਜੀ ਅਤੇ ਉਹ ਮਤਲਬ ਨਾ ਆਈ ਨਹੀਂ ਹੈਗੀ ਅਜੇ ਤੱਕ ਜੋ ਤੁਸੀਂ ਟਰੈਕਿੰਗ ਨੰਬਰ ਦਿੱਤਾ ਸੀ ਮੈਨੂੰ ਉਹ ਵੀ ਨਹੀਂ ਕੰਮ ਦਾ ਹੈ ਉਹ ਮੈਨੂੰ ਸ਼ੋਅ ਹੀ ਨਹੀਂ ਹੋ ਰਿਹਾ ਐਕਚੁਅਲ 'ਚ ਹਾਂਜੀ ਬਟ ਮੈਂ ਤਾਂ ਉਹਦੇ ਬਰਥਡੇ 'ਤੇ ਪਾਉਣੀ ਸੀ ਨਾ ਉਹ ਡ੍ਰੇਸ ਆਪਣੀ ਹੁਣ ਉਹ ਆਈ ਨਹੀਂ ਹੈਗੀ ਗੀ ਤਾਂ ਫਿਰ ਬਾਅਦ 'ਚ ਕਰਨਾ ਵੀ ਕੀ ਆ ਮੈਂ

ਇੱਦਾਂ ਹੈ ਨਾ ਤਾਂ ਮੈਨੂੰ ਤਾਂ ਮਤਲਬ ਉਹ ਹੋ ਗਿਆ ਨਾ ਮੈਂ ਤਾਂ ਹਰਾਸ ਹੋ ਗਈ ਨਾ ਤੁਹਾਡੀ ਹਾਂਜੀ ਮੈਂ ਟੋਟਲੀ ਹਰਾਸ ਹਾਂ ਤੁਹਾਡੇ ਤੋਂ ਬਿਲਕੁਲ ਮੈਨੂੰ ਬਿਲਕੁਲ ਵੀ ਤੁਹਾਡੀ ਸਰਵਿਸ ਅੱਛੀ ਨਹੀਂ ਲੱਗੀ ਗੀ ਹਾਂਜੀ ਤਾਂ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਅੱਗੇ ਸਾਡੇ ਫੰਕਸ਼ਨ ਆ ਰਿਹਾ ਹੈਗਾ ਕਿ ਠੀਕ ਹੈ ਕੀ ਉਦੋਂ ਤੱਕ ਮੇਰੀ ਉਹ ਡ੍ਰੇਸ ਆ ਜਾਵੇਗੀ ਅਗਰ ਉਹ ਮੇਰੀ ਡ੍ਰੇਸ ਨਹੀਂ ਤੁਸੀਂ ਪਹੁੰਚਾ ਸਕਦੇ ਨਾ ਮੇਰੇ ਤੱਕ ਤਾਂ ਪਲੀਜ਼ ਮੈਨੂੰ ਮੇਰੇ ਜਿਹੜੇ ਹੈਗੀ ਪੇਮੈਂਟ ਰਿਫੰਡ ਕਰ ਦਿਉ ਮੇਰਾ ਇੱਕ ਵੀ ਰੁਪੀਜ਼ ਉਹਦੇ ਵਿੱਚੋਂ ਕੱਟ ਨਹੀਂ ਹੋਣਾ ਚਾਹੀਦਾ ਗਾ ਹਰਾਸ ਤਾਂ ਤੁਸੀਂ ਮੈਨੂੰ ਕਰ ਹੀ ਦਿੱਤਾ ਹੈ ਬਰਡੇ 'ਤੇ ਮੈਂ ਪਾਉਣੀ ਸੀ ਆਪਣੀ ਡਰੈਸ ਉਦੋਂ ਤੱਕ ਉਹ ਮੈਨੂੰ ਮਿਲੀ ਨਹੀਂ ਠੀਕ ਹੈ ਤਾਂ ਪਲੀਜ਼ ਮੈਨੂੰ ਮੇਰੇ ਪੈਸੇ ਰਿਫੰਡ ਕਰ ਦਿਉ ਠੀਕ ਹੈ ਮੈਂ ਹਾਂਜੀ ਅਗਰ ਤੁਸੀਂ ਉਦੋ ਤੱਕ ਮੈਨੂੰ ਨਹੀਂ ਦੇ ਸਕਦੇ ਗੇ ਵਿਦ ਇਨ ਟੂ ਡੇਜ਼ ਮੈਨੂੰ ਨਹੀਂ ਦੇ ਸਕਦੇ ਤਾਂ ਮੈਨੂੰ ਪਲੀਜ਼ ਮੇਰੇ ਪੈਸੇ ਰਿਫੰਡ ਕਰ ਦਿਉ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ